ਮੈਨੂੰ ਮੇਰੇ ਮੋਬਾਈਲ ਦਾ ਬਿੱਲ ਕੱਲ੍ਹ ਪਰਸੋਂ ਮਿਲਿਆ ਹੈ ਪਰ ਮੈਨੂੰ ਆਪਣੇ ਮੋਬਾਈਲ ਦਾ ਬਿੱਲ ਅੱਜ ਫਿਰ ਪ੍ਰਾਪਤ ਹੋਇਆ ਹੈ ਮੇਰੇ ਮੋਬਾਈਲ 'ਤੇ ਮੈਸੇਜ ਜਾਂਦਾ ਹੈ ਬਟ ਇਹਨਾਂ ਦੀ ਆਪਸ ਦੇ ਵਿੱਚ ਰਕਮ ਮੈਚ ਨਹੀਂ ਹੁੰਦੀ ਹੈ ਮੈਨੂੰ ਸ਼ੱਕ ਹੈ ਕਿ ਮੇਰਾ ਜਿਹੜਾ ਮੋਬਾਈਲ ਦਾ ਬਿਲ ਇਹ ਸਹੀ ਨਹੀਂ ਹੈ ਅਤੇ ਇਹਦੀ ਪੁਸ਼ਟੀ ਕਰਨ ਲਈ ਜਾਂ ਤਾਂ ਮੈਂ ਮੋਬਾਈਲ ਦੇ ਆਫਿਸ ਜਾਊਂਗੀ ਜਿਹੜੀ ਵੀ ਕੰਪਨੀ ਦਾ ਮੇਰਾ ਸਿਮ ਹੈ ਇਹਦੀ ਪੁਸ਼ਟੀ ਦੀ ਭੁਗਤਾਨ ਕਰਨ ਵਾਸਤੇ ਫਿਰ ਮੈਨੂੰ ਇਹਨਾਂ ਦੇ ਆਫਿਸ ਦੇ ਵਿੱਚ ਜਾ ਕੇ ਹੀ ਚਰਚਾ ਕੀਤੀ ਜਾ ਸਕਦੀ ਹੈ